ਇੱਕ ਕਲਾਕਾਰ ਹੋਣ ਦੇ ਨਾਤੇ ਮੈਨੂੰ ਕਾਫੀ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਵੈਸੇ ਮਤਲਬ ਮੇਰੀ ਜਿਹੜੀ ਕਲਾਕਾਰੀ ਆ ਜਿਹੜੇ ਮੇਰੇ ਚਿੱਤਰ ਬਣਾਉਂਦੀ ਹਾਂ ਉਹ ਇੰਨੀ ਵੀ ਜ਼ਿਆਦਾ ਆਕਰਸ਼ਕ ਜਾਂ ਸੋਹਣੀ ਨਹੀਂ ਹੈ ਪਰ ਹਾਂ ਮੈਨੂੰ ਪਸੰਦ ਹੈ ਪੀ ਮੈਂ ਹੈ ਨਾ ਡਰੋਇੰਗ ਕਰਾ ਹੈ ਨਾ ਚਿੱਤਰ ਬਣਾਵਾਂ ਪਰ ਜਿਵੇਂ ਕਿ ਹੁਣ ਮੈਨੂੰ ਕਾਫੀ ਸਕੈਚ ਡਰਾਇੰਗ ਪੈਨਸਿਲ ਨਾਲ ਜਿਹੜੀ ਹੁੰਦੀ ਆ ਉਹ ਮੈਨੂੰ ਕਾਫੀ ਸੋਹਣੀ ਲੱਗਦੀ ਹੈ ਖਾਸਕਰ ਜਿਹੜੀ ਜਿਵੇਂ ਕਿ ਬਣਾਈ ਹੋਵੇ ਕਿਸੇ ਮਤਲਬ ਬੰਦੇ ਦੀ ਜਾਂ ਇਨਸਾਨ ਦੀ ਹੈ ਨਾ ਕਿਸੇ ਨੇ ਬਣਾਈ ਹੋਵੇ ਉਹ ਡਰੋਇੰਗਸ ਮੈਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਪਰ ਜਦੋਂ ਮੈਂ ਉਹਨਾਂ ਨੂੰ ਬਣਾਉਣ ਬੈਠਦੀ ਹਾਂ ਮੈਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਕਦੇ ਉਹਨਾਂ ਦਾ ਕੁਛ ਅੱਖ ਨਹੀਂ ਸਹੀ ਬਣਦੀ ਕਦੇ ਨੱਕ ਗੜਬੜ ਹੋ ਜਾਂਦਾ ਜਾਂ ਫਿਰ ਕਦੇ ਮੂੰਹ ਵਗੈਰਾ ਸਾਰਾ ਕੁਛ ਸ਼ੇਪ ਸਹੀ ਨਹੀਂ ਆਉਂਦੀ ਜਿਹਦੇ ਕਰਕੇ ਕਾਫੀ ਦਿੱਕਤ ਹੋ ਜਾਂਦੀ ਹੈ ਅਤੇ ਕਈ ਵਾਰ ਇਹੋ ਜਿਹੀਆਂ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ ਕਿ ਮੈਂ ਚਿੱਤਰ ਬਣਾਉਣ ਬੈਠ ਚੁੱਕੀ ਹਾਂ ਅਤੇ ਉਹ ਚਿੱਤਰ ਬਹੁਤ ਜ਼ਿਆਦਾ ਸੋਹਣਾ ਬਣ ਚੁੱਕਿਆ ਕੰਪਲੀਟ ਅੱਧਾ ਕੰਪਲੀਟ ਹੋ ਚੁੱਕਿਆ ਪਰ ਮੇਰਾ ਜਿਹੜਾ ਸਮਾਨ ਹੈ ਮੇਰੇ ਜਿਹੜੇ ਰੰਗ ਆ ਉਹ ਘੱਟ ਜਾਂਦੇ ਹੈ ਉਹਦੇ ਕਰਕੇ ਵੀ ਕਾਫੀ ਦਿੱਕਤ ਹੋ ਜਾਂਦੀ ਹੈ ਕਈ ਵਾਰ ਵੀ ਹੁਣ ਕੋਈ ਹੁੰਦਾ ਨਹੀਂ ਘਰੇ ਵੀ ਜਿਹੜਾ ਲਿਆ ਸਕੇ ਸਮਾਨ ਮੈਨੂੰ ਦੇ ਸਕੇ ਉਹਦੇ ਕਰਕੇ ਵੀ ਮੈਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਵੀ ਜਦੋਂ ਮੇਰੇ ਕੋਲ ਪੂਰਾ ਸਮਾਨ ਨਹੀਂ ਹੁੰਦਾ ਕਈ ਵਾਰ ਜਦੋਂ ਮੈਂ ਕਾਫੀ ਰੀਝ ਨਾਲ ਹੈ ਨਾ ਬਣਾਉਣ ਬੈਠਦੀ ਹਾਂ ਜਦੋਂ ਚਿੱਤਰ ਕਈ ਵਾਰ ਕੋਈ ਰੰਗ ਹੀ ਹੁੰਦਾ ਜਿਹੜਾ ਮੇਰੇ ਚਿੱਤਰ ਦੇ ਉੱਤੇ ਹੈ ਨਾ ਰੰਗ ਡੁੱਲ੍ਹ ਜਾਂਦਾ ਉਹਦੇ ਕਰਕੇ ਵੀ ਬਹੁਤ ਮੈਨੂੰ ਬੜਾ ਪਛਤਾਵਾ ਹੁੰਦਾ ਕਿ ਕਿਉਂ ਹੈ ਨਾ ਐਵੇਂ ਹੋ ਗਿਆ ਮੈਨੂੰ ਬੜਾ ਹੁੰਦਾ ਵੀ ਕਿਉਂ ਹੋ ਗਿਆ ਅਤੇ ਹੋਰ ਵੀ ਕਾਫੀ ਮੁਸ਼ਕਿਲਾਂ ਹੁੰਦੀਆਂ ਹਨ ਜਦੋਂ ਜਾਂ ਫਿਰ ਚਿੱਤਰ ਦਾ ਪੂਰਾ ਬਣ ਚੁੱਕਿਆ ਪਰ ਕ ਉਹ 'ਚ ਕੋਈ ਕਮੀ ਪੇਸ਼ੀ ਰਹਿ ਗਈ ਹੈ ਰੰਗ ਬਾਹਰ ਨਿਕਲ ਗਿਆ ਇਹ ਸਾਰੀ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਪਰ ਫਿਲਹਾਲ ਤਾਂ ਇਹ ਜੇ ਇਹੀ ਸੀ ਜੋ ਮੇਰੇ ਮੈਨੂੰ ਹਾਲੇ ਮੁਸ਼ਕਿਲਾਂ ਦਾ ਕਰਨਾ ਪੈਂਦਾ ਸਾਹਮਣਾ ਬਸ